ਮੈਨੂੰ ਕਦੇ ਪੰਜਾਬੀ ਲਿਖਣ ਅਤੇ ਬੋਲਣ ਵਿੱਚ ਬਹੁਤੀ ਮੁਸ਼ਕਿਲ ਨਹੀਂ ਆਈ ਕਿਉਂਕਿ ਮੈਂ ਆਰੰਭ ਤੋਂ ਹੀ ਪੰਜਾਬੀ ਸਕੂਲ ਅਤੇ ਪੰਜਾਬੀ ਮਾਧਿਅਮ ਵਿੱਚ ਪੜ੍ਹਿਆ ਹਾਂ ਪੰਜਾਬੀ ਮੇਰੀ ਮਾਂ ਬੋਲੀ ਹੈ ਇਸ ਨੂੰ ਲਿਖਣ ਬੋਲਣ ਅਤੇ ਪੜ੍ਹਨ ਵਿੱਚ ਮੈਂ ਪੂਰੀ ਤਰ੍ਹਾਂ ਨਿਪੁੰਨ ਹਾਂ ਹਾਂ ਕੁਝ ਅੰਗਰੇਜ਼ੀ ਸ਼ਬਦ ਜਿਵੇਂ ਕਿ ਇਨਸਾਈਕਲੋਪੀਡੀਆ ਇਹੋ ਜਿਹੇ ਕੁਝ ਹੋਰ ਅੰਗਰੇਜ਼ੀ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਸਿੱਧੇ ਰੂਪ ਦੇ ਵਿੱਚ ਉਸੇ ਤਰ੍ਹਾਂ ਪੰਜਾਬੀ ਵਿੱਚ ਲਿਖਦੇ ਹਾਂ ਉਦੋਂ ਪੰਜਾਬੀ ਲਿਖਣ ਦੇ ਵਿੱਚ ਜ਼ਰੂਰ ਉਸ ਸ਼ਬਦ ਦੀ ਸਮੱਸਿਆ ਆਉਂਦੀ ਹੈ ਉਂਝ ਆਮ ਤੌਰ ਉੱਤੇ ਬੋਲਣ ਲਿਖਣ ਅਤੇ ਪੜ੍ਹਨ ਵਿੱਚ ਸਾਨੂੰ ਕੋਈ ਸਮੱਸਿਆ ਨਹੀਂ ਹੈ ਅਸੀਂ ਆਪਣੇ ਆਲੇ ਦੁਆਲੇ ਆਪਣੇ ਗੁਆਂਢੀਆਂ ਦੋਸਤਾਂ ਰਿਸ਼ਤੇਦਾਰਾਂ ਅਤੇ ਸਭ ਨਾਲ ਪੰਜਾਬੀ ਵਿੱਚ ਹੀ ਬੋਲ ਕੇ ਗੱਲ ਕਰਦੇ ਹਾਂ ਅਤੇ ਸਾਡੇ ਜ਼ਿਆਦਾਤਰ ਕਾਰਜ ਜਿਹੜੇ ਅਸੀਂ ਲਿਖ ਕੇ ਕਰਦੇ ਹਾਂ ਉਹ ਵੀ ਪੰਜਾਬੀ ਵਿੱਚ ਹੀ ਕੀਤੇ ਜਾਂਦੇ ਹਨ ਜਿਸ ਕਰਕੇ ਇਸ ਬੋਲੀ ਵਿੱਚ ਜਿਹੜੀ ਕਿ ਮੇਰੀ ਮਾਂ ਬੋਲੀ ਹੈ ਪੰਜਾਬੀ ਬੋਲਣ ਲਿਖਣ ਅਤੇ ਪੜ੍ਹਨ ਦੀ ਮੈਨੂੰ ਕੋਈ ਵੀ ਸਮੱਸਿਆ ਨਹੀਂ ਹੈ ਧੰਨਵਾਦ